ਪੰਜਾਬੀਆਂ ਦੇ ਵਿੱਚ ਇੱਕ ਬੜੀ ਪੁਰਾਣੀ ਸਮੇਂ ਤੋਂ ਚੱਲੀ ਆ ਰਹੀ ਹੈ ਕਿ ਪੰਜਾਬੀ ਜਿਹੜੇ ਨੇ ਹਰ ਪਲ ਹਰ ਸਰਦੀਆਂ ਕੋਈ ਨਾ ਕੋਈ ਮਿੱਠਾ ਜਿਸ ਤਰ੍ਹਾਂ ਪਿੰਨੀਆਂ ਵੇਸਣ ਦੇ ਲੱਡੂ ਇਸ ਤਰ੍ਹਾਂ ਦੀ ਕੋਈ ਨਾ ਕੋਈ ਚੀਜ਼ ਜਰੂਰ ਬਣਾਉਂਦੇ ਨੇ ਠੀਕ ਹੈ ਇਸ ਕਰਕੇ ਜਦੋਂ ਮੈਂ ਵੀ ਸਰਦੀਆਂ 'ਚ ਇਹੋ ਜਿਹਾ ਕੋਈ ਕੰਮ ਕਰਦੀ ਹਾਂ ਤਾਂ ਹਮੇਸ਼ਾ ਆਪਣੀ ਸੱਸ ਨੂੰ ਨਾਲ ਲੈ ਕੇ ਉਹਨਾਂ ਦੇ ਵਿਚਾਰ ਪੁੱਛ ਕੇ ਫਿਰ ਹੀ ਕਰਦੀ ਹਾਂ ਅਸੀਂ ਜਿੰਨੇ ਮਰਜ਼ੀ ਅੱਗੇ ਨਿਕਲ ਜਾਈਏ ਜਿੰਨੇ ਮਰਜ਼ੀ ਆਪਣੀ ਕੁਕਿੰਗ 'ਚ ਪਰਫੈਕਟ ਹੋ ਜਾਈਏ ਲੇਕਿਨ ਜੋ ਪਹਿਲੇ ਲੋਕਾਂ ਦੀਆਂ ਹੈਗੇ ਆ ਤਰੀਕੇ ਉਹ ਕਿਤੇ ਨਾ ਕਿਤੇ ਸਾਡੇ ਕੰਮ ਜ਼ਰੂਰ ਆਉਂਦੇ ਹਨ ਜਦੋਂ ਜਿਵੇਂ ਕਿ ਇਸ ਵਾਰੀ ਅਸੀਂ ਬੇਸਣ ਦੇ ਲੱਡੂ ਬਣਾਏ ਮੇਰੇ ਮਦਰ ਇਨ ਲੋ ਨੇ ਮੈਨੂੰ ਬੜੇ ਤਰੀਕੇ ਹੋਰ ਵੀ ਦੱਸੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਬਦਲਾਅ ਕਰ ਸਕਦੇ ਹਾਂ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਕਈ ਪਰਿਵਾਰਿਕ ਗੱਲਾਂ ਵੀ ਕਰਦੇ ਹਾਂ ਇੱਕ ਦੂਜੇ ਦੇ ਹੋਰ ਕਰੀਬ ਆਉਂਦੇ ਹਾਂ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਜਦੋਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਸਾਡਾ ਪਿਆਰ ਹੋਰ ਵੱਧ ਰਿਹਾ ਇਸ ਕਰਕੇ ਰਸੋਈ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਕੰਮ ਕਰਕੇ ਤੁਸੀਂ ਆਪਣਿਆਂ ਦੇ ਹੋਰ ਕਰੀਬ ਆਉਂਦੇ ਹੋ ਜਦੋਂ ਆਪਣੇ ਉਸ ਚੀਜ਼ ਦੀ ਪ੍ਰਸ਼ੰਸਾ ਕਰਦੇ ਹਨ ਤੁਹਾਨੂੰ ਕੁਛ ਸਿਖਾਉਂਦੇ ਹਨ ਤਾਂ ਹੋਰ ਵੀ ਵਧੀਆ ਲੱਗਦਾ ਹੈ ਕਿ ਅਸੀਂ ਵਾਕਈ ਕੁਛ ਚੰਗਾ ਕਰ ਰਹੇ ਹਾਂ ਜਿੰਨੇ ਮਰਜ਼ੀ ਵੱਡੇ ਹੋ ਜਾਈਏ ਵੱਡਿਆਂ ਦੀ ਸੀਖ ਹਮੇਸ਼ਾ ਕੰਮ ਆਉਂਦੀ ਹੈ